ਮੈਨੂੰ ਢਾਬਿਆਂ ਦੀ ਸ਼ਾਨ ਸੇਵ ਭਾਜੀ ਬਹੁਤ ਪਸੰਦ ਹੈ ਕਿਉਂਕਿ ਉਹ ਇੱਕ ਤਾਂ ਘੈਂਟ ਬਹੁਤ ਬਣਦੀ ਇੱਕ ਬਣਦੀ ਦੁੱਧ ਦੇ ਵਿੱਚ ਹੈ ਔਰ ਉਹਦੇ ਨਾਲ਼ ਜਿਹੜੀ ਤੰਦੂਰੀ ਰੋਟੀ ਹੈ ਵਿੱਚ ਮੱਖਣ ਦੀ ਟਿੱਕੀ ਪਾ ਕੇ ਤੰਦੂਰੀ ਰੋਟੀ ਨੂੰ ਮੱਖਣ ਲਾ ਕੇ ਉਹ ਬਹੁਤ ਵਧੀਆ ਬਣਦੀ ਹੈ ਜੋ ਕਿ ਜਿਹੜਾ ਬੰਦਾ ਵੀ ਇੱਕ ਵਾਰ ਖਾ ਲੈਂਦਾ ਹੈ ਉਹ ਬੰਦੇ ਨੂੰ ਦੁਬਾਰੇ ਚਾਹਨਾ ਹੁੰਦੀ ਹੈ ਵੀ ਦੁਬਾਰੇ ਖਾਧੀ ਜਾਵੇ